ਕੀ ਤੁਸੀਂ ਗਾਲ ਕੋਸਮੈਟਿਕ ਤੋਂ ਬੋਲ ਰਹੇ ਹੋ ਕੱਲ੍ਹ ਮੈਂ ਤੁਹਾਡੇ ਇੱਥੋਂ ਹੈਆਰ ਆਇਲ ਖਰੀਦਿਆ ਸੀ ਜਿਸ ਦੀ ਕਿ ਤੁਸੀਂ ਬਹੁਤ ਜ਼ਿਆਦਾ ਤਾਰੀਫ ਕੀਤੀ ਹੋਈ ਸੀ ਕਿ ਉਹਦੇ ਨਾਲ ਵਾਲ ਬਹੁਤ ਸ਼ਾਈਨ ਕਰਨਗੇ ਬਹੁਤ ਲੰਬੇ ਹੋਣਗੇ ਅਤੇ ਸਿੱਕਰੀ ਹੈ ਅਤੇ ਉਹ ਜਲ ਜਾਵੇਗੀ ਬਹੁਤ ਤਾਰੀਫ ਸੁਣੀ ਸੀ ਮੈਂ ਉਹਨਾਂ ਦੀ ਅਤੇ ਮੈਂ ਇਸ ਕਰਕੇ ਉਹ ਖਰੀਦਿਆ ਜਦੋਂ ਕਿ ਉਹ ਇੰਨਾ ਮਹਿੰਗਾ ਸੀ ਉਹਦੇ ਬਾਵਜੂਦ ਵੀ ਪਰ ਜਦੋਂ ਕਿ ਜਦੋਂ ਮੈਂ ਉਹ ਯੂਜ ਕੀਤਾ ਤਾਂ ਮੇਰੇ ਵੱਧ ਤੋਂ ਵੱਧ ਬਾਲ ਝੜਨ ਲੱਗ ਪਏ ਸਿੱਕਰੀ ਬਹੁਤ ਜ਼ਿਆਦਾ ਹੋ ਗਈ ਅਤੇ ਸ਼ਾਈਨ ਤਾਂ ਕਿਸੇ ਕੰਮ ਦੀ ਹੀ ਨਹੀਂ ਰਹੀ ਮੇਰੇ ਵਾਲਾਂ 'ਤੇ ਤੁਸੀਂ ਬਹੁਤ ਹੀ ਘਟੀਆ ਹੇਅਰ ਆਇਲ ਵੇਚਿਆ ਉਹਨਾਂ ਦੀ ਗਲਤ ਪ੍ਰਚਾਰ ਕਰਕੇ ਅਤੇ ਮੈਨੂੰ ਹੁਣ ਜਾਂ ਤਾਂ ਤੁਸੀਂ ਮੇਰੇ ਸਾਰੇ ਪੈਸੇ ਵਾਪਿਸ ਕਰੋ ਨਹੀਂ ਤਾਂ ਮੈਂ ਤੁਹਾਡੀ ਸ਼ਿਕਾਇਤ ਕਰਾਂਗੀ ਅਤੇ ਆਪਣੇ ਜਿੰਨੇ ਵੀ ਜਾਣ ਪਹਿਚਾਣ ਵਾਲੇ ਹੈ ਉਹਨਾਂ ਸਭ ਨੂੰ ਕਹੂੰਗੀ ਕਿ ਇਸ ਤੋਂ

ਦੋਸਤ ਹੈ ਜਾਂ ਸਭ ਸਭ ਨੂੰ ਦੱਸੂਗੀ ਵੀ ਤੁਹਾਡੀ ਦੁਕਾਨ ਤੋਂ ਕੋਈ ਪ੍ਰੋਡਕਟ ਨਾ ਖਰੀਦਿਆ ਜਾਵੇ ਤੁਸੀਂ ਜਲਦੀ ਜਲਦੀ ਮੇਰੇ ਪੈਸੇ ਵਾਪਿਸ ਕਰੋ ਨਹੀਂ ਤਾਂ ਤੁਹਾਡੀ ਕੰਪਲੇਨ ਕਰ ਦਊਂਗੀ ਮੈਂ